ਜੀ ਹਾਂ ਸਾਡੇ ਇੱਧਰ ਬਹੁਤ ਸੁੰਦਰ ਕੇਂਦਰ ਹੈ ਜਿੱਦਾਂ ਮੈਂ ਤੁਹਾਨੂੰ ਝੀਲ ਦੇ ਬਾਰੇ ਦੱਸਣ ਜਾ ਰਿਹਾ ਹਾਂ ਸਾਡੇ ਇੱਧਰ ਇੱਕ ਝੀਲ ਹੈ ਜਿਸ ਦਾ ਨਾਮ ਮਿਨੀ ਗੋਆ ਨਾਂ ਸਥਿਤ ਹੈ ਉੱਧਰ ਬਹੁਤ ਹੀ ਬੜੀ ਝੀਲ ਹੈ ਉੱਧਰ ਇੱਕ ਦੋ ਤਿੰਨ ਬਹੁਤ ਜ਼ਿਆਦਾ ਬੂਟੇ ਲੱਗੇ ਹੋਏ ਹਨ ਉੱਧਰ ਨ ਝੀਲ ਵਿੱਚ ਲੋਕ ਵੋਟਿੰਗ ਵੀ ਕਰਦੇ ਹਨ ਅਤੇ ਉੱਧਰ ਖਾਣ ਦਾ ਸਾਰਾ ਪ੍ਰਬੰਧ ਹੈ ਜਦੋਂ ਮੈਂ ਉੱਥੇ ਗਿਆ ਸੀ ਤਾਂ ਮੇਰਾ ਅਨੁਭਵ ਬਹੁਤ ਹੀ ਚੰਗਾ ਰਿਹਾ ਸੀ ਮੈਂ ਆਪਣੇ ਘਰ ਵਾਲਿਆਂ ਨਾਲ ਉੱਧਰ ਗਿਆ ਸੀ ਅਤੇ ਮੇਰੇ ਘਰ ਵਾਲਿਆਂ ਦਾ ਵੀ ਅਨੁਭਵ ਬਹੁਤ ਹੀ ਚੰਗਾ ਰਿਹਾ ਸੀ ਉੱਧਰ ਸਾਨੂੰ ਬਹੁਤ ਹੀ ਮਜ਼ਾ ਆਇਆ ਸੀ ਸਾਰੇ ਲੋਕ ਉੱਧਰ ਅਲੱਗ ਅਲੱਗ ਕੱਪੜਿਆਂ ਨਾਲ ਆਏ ਸੀ ਕਈ ਉੱਧਰ ਅੱਧੇ ਅੱਧੇ ਕੱਪੜਿਆਂ 'ਚ ਸੀ ਅਤੇ ਕਈ ਪੂਰੇ ਪੂਰੇ ਕੱਪੜਿਆਂ 'ਚ ਸੀ ਉੱਧਰ ਅਸੀਂ ਸੁੱਤੇ ਵੀ ਸੀ ਉੱਧਰ ਬਹੁਤ ਠੰਡੀ ਅਤੇ ਤਾਜ਼ਾ ਹਵਾ ਚਲਦੀ ਸੀ ਉੱਧਰ ਬਹੁਤ ਮਜ਼ਾ ਆ ਰਿਹਾ ਸੀ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ ਉੱਧਰ ਲੈ ਕੇ ਜਾਣਾ ਚਾਹੁੰਦਾ ਹਾਂ